ਮੇਰੀ ਮਨਪਸੰਦ ਖੇਡਾਂ ਦੇ ਵਿੱਚ ਪਹਿਲੇ ਨੰਬਰ 'ਤੇ ਤਾਂ ਕ੍ਰਿਕਟ ਹੀ ਆਉਂਦੀ ਹੈ ਇਹ ਮੇਰੀ ਸਭ ਤੋਂ ਮਨ ਪਸੰਦ ਖੇਡ ਹੈ ਇਹ ਮੈਂ ਇਕੱਲਾ ਵੇਖਣਾ ਹੀ ਨਹੀਂ ਪਰ ਉਸ ਨੂੰ ਖੇਡਣਾ ਵੀ ਬਹੁਤ ਜ਼ਿਆਦਾ ਪਸੰਦ ਕਰਦਾ ਹਾਂ ਜਿੰਨਾ ਮਜ਼ਾ ਵੇਖਣ 'ਤੇ ਆਉਂਦਾ ਹੈ ਉਸ ਨਾਲੋਂ ਜ਼ਿਆਦਾ ਮਜਾ ਤਾਂ ਉਸ ਨੂੰ ਖੇਡਣ 'ਤੇ ਹੀ ਆ ਜਾਂਦਾ ਹੈ ਇਸ ਦੇ ਵਿੱਚ ਇਹ ਫ਼ਾਇਦਾ ਹੁੰਦਾ ਹੈ ਪਹਿਲਾਂ ਤਾਂ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਦੂਜਾ ਸਾਡੇ ਸਰੀਰ ਦੇ ਵਿੱਚ ਕੋਈ ਵੀ ਬਿਮਾਰੀ ਪੈਦਾ ਨਹੀਂ ਹੁੰਦੀ ਪਰ ਇਸ ਸਮੇਂ ਸਾਡੇ ਇੱਥੇ ਗਰਾਊਂਡਾਂ ਵੀ ਬਹੁਤ ਜ਼ਿਆਦਾ ਹੈ ਇਸ ਕਰਕੇ ਮੈਂ ਇਸ ਨੂੰ ਖੇਡਣਾ ਵੀ ਬਹੁਤ ਜ਼ਿਆਦਾ ਪਸੰਦ ਕਰਦਾ ਹਾਂ ਇਹ ਰਾਸ਼ਟਰ ਖੇਡ ਵੀ ਹੈ ਅੰਤਰਰਾਸ਼ਟਰੀ ਖੇਡ ਵੀ ਹੈ ਅਤੇ ਸਥਾਨਕ ਖੇਡ ਵੀ ਹੈ ਇੱਥੋਂ ਦਾ ਜਿੱਥੋਂ ਦਾ ਮਰਜ਼ੀ ਬੱਚਾ ਲੈ ਲਓ ਉਹ ਇਹ ਕ੍ਰਿਕਟ ਖੇਡਦਾ ਹੀ ਹੋਵੇਗਾ ਅਤੇ ਉਸ ਦੀ ਮਨ ਪਸੰਦ ਖੇਡ ਜੇ ਕਿਸੇ ਅੱਜ ਕੱਲ੍ਹ ਦੇ ਬੱਚੇ ਨੂੰ ਨੌਜਵਾਨ ਨੂੰ ਜਾਂ ਕਿਸੇ ਨੂੰ ਵੀ ਪੁੱਛ ਲਓਗੇ ਅਤੇ ਉਸਦਾ ਪਸੰਦੀਦਾ ਖੇਡ ਕ੍ਰਿਕਟ ਹੀ ਬਣ ਜਾਵੇਗਾ ਇਹ ਕੁਝ ਸਾਲਾਂ ਤੋਂ ਬਹੁਤ ਹੀ ਜ਼ਿਆਦਾ ਕੁਝ ਸਾਲਾਂ ਕੀ ਪੁਰਾਣੇ ਸਮੇਂ ਤੋਂ ਹੀ ਬਹੁਤ ਪ੍ਰਚੱਲਿਤ ਹੁੰਦਾ ਆਇਆ ਹੈ ਅਤੇ ਅੱਗੋਂ ਵੀ ਪ੍ਰਚੱਲਿਤ ਹੁੰਦਾ ਹੀ ਆਵੇਗਾ ਤੁਹਾਨੂੰ ਕਿ ਜਿਵੇਂ ਪਤਾ ਹੀ ਹੋਵੇਗਾ ਅੱਜ ਕੱਲ੍ਹ ਤਾਂ ਬਹੁਤ ਹੀ ਵੱਡੇ ਵੱਡੇ ਅਤੇ ਉੱਚਤਮ ਖਿਡਾਰੀ ਆ ਰਹੇ ਹਨ ਸਾਡੀਆਂ ਛੋਟੀਆਂ ਟੀਮਾਂ ਅਤੇ ਆਉਣ ਵਾਲੀ ਵੱਡੀਆਂ ਟੀਮਾਂ ਵੀ ਬਹੁਤ ਵੱਡੀਆਂ ਵੱਡੀਆਂ ਅਤੇ ਬਹੁਤ ਹੀ ਵਧੀਆ ਤਿਆਰ ਹੋ ਰਹੀਆਂ ਹਨ ਇਸ ਨਾਲ ਵਾਧਾ ਇਹ ਹੋ ਰਿਹਾ ਹੈ ਕਿ ਸਾਡੀ ਅੰਤਰਰਾਸ਼ਟਰੀ ਜਿਹੜੀ ਟੀਮ ਹੈਗੀ ਆ ਉਹ ਬਹੁਤ ਹੀ ਵਧੀਆ ਖੇਡ ਰਹੀ ਹੈ ਜਿਸ ਨਾਲ ਆਪਾਂ ਨਵੀਂ ਨਵੀਂ ਜਿੱਤਾਂ ਨੂੰ ਆਨੰਦ ਮਾਣਦੇ ਹਾਂ ਇਹ ਦੂਸਰੀ ਗੱਲ ਜਿੱਥੋਂ ਤੱਕ ਰਹੀ ਗੱਲ ਦੇਖਣ ਦੀ ਇਸ ਨੂੰ ਦੇਖਣ 'ਤੇ ਵੀ ਉੰਨਾ ਹੀ ਜ਼ਿਆਦਾ ਮਜ਼ਾ ਆਉਂਦਾ ਹੈ ਜਿੰਨਾ ਖੇਡਣ 'ਤੇ ਆਉਂਦਾ ਹੈ ਦੇਖਣ ਨਾਲ ਸਾਡੇ ਵਿੱਚ ਉਤਸ਼ਾਹ ਭਰ ਜਾਂਦਾ ਹੈ ਕਿ ਕਿਹੜੀ ਟੀਮ ਕਿੰਨੀ ਜ਼ਿਆਦਾ ਸਕੋਰ ਮਾਰੂਗੀ ਜਾਂ ਕਿਹੜੀ ਟੀਮ ਕਦੋਂ ਤੱਕ ਆਊਟ ਹੋ ਜਾਊਗੀ ਇਸੇ ਕਰਕੇ ਮੈਂ ਇਸ ਨੂੰ ਇਕੱਲਾ ਖੇਡਣਾ ਨਹੀਂ ਦੇਖਣਾ ਵੀ ਪਸੰਦ ਕਰਾਂਗਾ ਧੰਨਵਾਦ